ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਸਮਾਜ ਸਹੂਲਤਾਂ ਹਨ ਜਿਵੇਂ ਪੜ੍ਹਾਈ ਲਈ ਸਿਹਤ ਲਈ ਗਰੀਬੀ ਘਟਾਉਣ ਲਈ ਔਰਤਾਂ ਦੀ ਰੱਖਿਆ ਲਈ ਵੀ ਬਹੁਤ ਸਾਰੀਆਂ ਸਮਾਧਾਨ ਹੈਗੇ ਹੈ ਪਰ ਕਈ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਿੱਥੇ ਕੀ ਕੀ ਸਮਾਧਾਨ ਹੈਗੇ ਹੈ ਕਿੱਥੇ ਕੀ ਨਹੀਂ ਹੈਗੇ ਵੈਸੇ ਤਾਂ ਸਿੱਖਿਆ ਲਈ ਵੀ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਕੱਢੀਆਂ ਹੋਈਆਂ ਵਾ ਸਿਹਤ ਲਈ ਵੀ ਕੱਢੀਆਂ ਹੋਈਆਂ ਵਾ ਕਈ ਕਈ ਲੋਕ ਇਹਦਾ ਫਾਇਦਾ ਲੈ ਵੀ ਰਹੇ ਹਨ ਕਈ ਨਹੀਂ ਵੀ ਲੈ ਰਹੇ ਕਈ ਖੇਤੀਬਾੜੀ ਲਈ ਵੀ ਸਹੂਲਤਾਂ ਕੱਢੀਆਂ ਹੋਈਆਂ ਵਿਕਾਸ ਪ੍ਰੋਗਰਾਮਾਂ ਲਈ ਵੀ ਸਹੂਲਤਾਂ ਕੱਢੀਆਂ ਹੋਈਆਂ ਹਨ ਪਰ ਕਈ ਬਹੁਤ ਜ਼ਿਆਦਾ ਦੂਰ ਰਹਿਣ ਵਾਲੇ ਲੋਕ ਮਤਲਬ ਬਹੁਤ ਜ਼ਿਆਦਾ ਪਿੰਡਾਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਸਰਕਾਰ ਨੇ ਕੀ ਕੀ ਸਾਡੇ ਲਈ ਸਹੂਲਤਾਂ ਕੱਢ ਕੇ ਰੱਖੀਆਂ ਹੋਈਆਂ ਹਨ ਕਈ ਪਿੰਡਾਂ ਥਾਵਾਂ ਦੇ ਲੋਕ ਅੱਜ ਕੱਲ੍ਹ ਦੀਆਂ ਔਰਤਾਂ ਨੂੰ ਬਹੁਤ ਜ਼ਿਆਦਾ ਜਿਵੇਂ ਉਹਨਾਂ 'ਤੇ ਮਾੜਾ ਪ੍ਰਭਾਵ ਹੈ ਬਹੁਤ ਜ਼ਿਆਦਾ ਉਹਨਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਨਾਲ ਚੰਗਾ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਹਮੇਸ਼ਾ ਨੀਵਾਂ ਨੀਵਾਂ ਰੱਖਿਆ ਜਾਂਦਾ ਉਹਨਾਂ ਔਰਤਾਂ ਨੂੰ ਹਮੇਸ਼ਾ ਬਸ ਘਰ ਦੀ ਘਰ ਗ੍ਰਸਤੀ ਵਿੱਚ ਹੀ ਬੰਦ ਕਰਕੇ ਰੱਖਿਆ ਜਾਂਦਾ ਅਤੇ ਕਈ ਬੱਚਿਆਂ ਨੂੰ ਵੀ ਅੱਜ ਕੱਲ੍ਹ ਦੇ ਲੋਕ ਪੜ੍ਹਾ ਨਹੀਂ ਰਹੇ ਕੁਛ ਨਹੀਂ ਕਰ ਰਹੇ ਬਸ ਉਹਨਾਂ ਨੂੰ ਕੰਮਾਂ ਕਾਰਾਂ 'ਤੇ ਸੁੱਟ ਰਹੇ ਆ ਬਸ ਇਹ ਕੰਮ ਕਾਰ ਕਰਨਗੇ ਸਾਡੇ ਲਈ ਪੈਸੇ ਲੈ ਕੇ ਆਉਣਗੇ ਆਪਾਂ ਉਹਨਾਂ ਨਾਲ ਗੁਜ਼ਾਰਾ ਕਰ ਲਵਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਬੱਚਿਆਂ ਦਾ ਵੀ ਫਿਊਚਰ ਖਰਾਬ ਹੋ ਰਿਹਾ ਅੱਗੇ ਜਾ ਕੇ ਬੱਚੇ ਕੀ ਕੁਛ ਕਰਨਗੇ ਕੀ ਨਹੀਂ ਕਰਨਗੇ ਕੁਛ ਨਹੀਂ ਸਾਨੂੰ ਪਤਾ ਉਹਨਾਂ ਨੂੰ ਇਸ ਗੱਲ ਦੀ ਨੌਲੇਜ ਹੀ ਨਹੀਂ ਹੈਗੀ ਕਿ ਉਹ ਕੀ ਕੁਛ ਕਰਨਗੇ ਹੈ ਬਹੁਤ ਸਾਰੇ ਇਹਨਾਂ ਦੇ ਬਹੁਤ ਸਾਰੀਆਂ ਕੀ ਕਹਾਂ ਕਿ ਤੁਹਾਨੂੰ ਕੁਛ ਕਹਿ ਨਹੀਂ ਸਕਦੇ ਬਹੁਤ ਬਹੁਤ ਪ੍ਰੋਗਰਾਮ ਹੈਗੇ ਆ ਤੁਸੀਂ ਖੇਤਰ ਦੇ ਲੋਕਾਂ ਨੂੰ ਸਹੂਲਤ ਦੇਣ ਬਾਰੇ ਸਰਕਾਰੀ ਸਕੀਮ ਬਾਰੇ ਆਪਾਂ ਤਾਂ ਬੜਾ ਕੁਛ ਜਾਣਦੇ ਹਾਂ ਕਈ ਜਿਵੇਂ ਕਿ ਹੁਣ ਅੱਜ ਕੱਲ੍ਹ ਤਾਂ ਫੇਸਬੁਕ ਇੰਸਟਾਗ੍ਰਾਮਾਂ 'ਤੇ ਪਤਾ ਚੱਲ ਜਾਂਦਾ ਜਿਵੇਂ ਅਨਮੋਲ ਵਗੈਰਾ ਆ ਗਏ ਹੈ ਕਈ ਲੋਕਾਂ ਦੀਆਂ ਲੱਤਾਂ ਟੁੱਟੀਆਂ ਹੁੰਦੀਆਂ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਕੁਛ ਵੀ ਨਜ਼ਰ ਨਹੀਂ ਆਉਂਦਾ ਉਹਨਾਂ ਲਈ ਵੀ ਬੜੀਆਂ ਸਹੂਲਤਾਂ ਕੱਢੀਆਂ ਗਈਆਂ ਹੋਈਆਂ ਵਾ ਬਸ ਅੱਜ ਕੱਲ੍ਹ ਬਸ ਇਹੀ ਹੈ ਕਿ ਅੱਜ ਕੱਲ੍ਹ ਦੇ ਲੋਕਾਂ ਨੂੰ ਆਪਣਾ ਵੇਖਣਾ ਚਾਹੀਦਾ ਪੜ੍ਹਾਉਣਾ ਚਾਹੀਦਾ ਹੈ ਸਿਹਤ ਦਾ ਧਿਆਨ ਖੁਦ ਰੱਖਣਾ ਚਾਹੀਦੀਆਂ ਵਾ ਠੀਕ ਹੈ ਨਾ